ਟੈਕਨੋਲਜੀ ਦੀ ਵਰਤੋਂ ਨਾਲ਼ ਸਾਡੇ ਆਲ਼ੇ ਦੁਆਲ਼ੇ ਦੇ ਗੱਲ ਕਰਨ ਦੇ ਤਰੀਕਿਆਂ ਦੇ ਵਿੱਚ ਕਾਫ਼ੀ ਬਦਲਾਵ ਆਇਆ ਹੈ ਜਿਸ ਨਾਲ਼ ਕਿ ਸਭ ਤੋਂ ਪਹਿਲਾਂ ਅਸੀਂ ਕਿਤੇ ਵੀ ਹੋਈਏ ਅਤੇ ਕਿਸੇ ਨਾਲ਼ ਗੱਲ ਕਰਨ ਦੀ ਇੱਛਾ ਰੱਖਦੇ ਹਾਂ ਤਾਂ ਅਸੀਂ ਉਨ੍ਹਾਂ ਦੇ ਨਾਲ਼ ਬਹੁਤ ਹੀ ਜਲ਼ਦੀ ਗੱਲ ਕਰ ਸਕਦੇ ਹਾਂ ਤਰੀਕੇ ਦੇ ਵਿੱਚ ਬਦਲਾਵ ਬਹੁਤ ਸਾਰੇ ਹਨ ਬੱਟ ਪਰ ਮੈਂ ਸੋ ਸ਼ੋਸ਼ਲ ਮੀਡੀਆ 'ਤੇ ਲੋਕਾਂ ਨੂੰ ਨੇੜੇ ਆਉਣ ਦੇ ਵਿੱਚ ਵੀ ਮਦਦ ਕੀਤੀ ਹੈ ਸਾਨੂੰ ਆਪਣੇ ਰੁਝੇਵੇਂ ਰੁੱਝੀ ਹੋਈ ਜ਼ਿੰਦਗੀ ਦੇ ਵਿੱਚੋਂ ਲੋਕਾਂ ਬਾਰੇ ਪਤਾ ਲੱਗਦਾ ਹੈ ਕਿ ਲੋਕ ਕੀ ਕਰ ਰਹੇ ਹਨ ਕਿਵੇਂ ਆਪਣੀ ਜ਼ਿੰਦਗੀ ਜਿਓ ਰਹੇ ਹਨ ਕਿਉਂਕਿ ਘਰ ਬੈਠੇ ਸਾਨੂੰ ਕੁਛ ਪਤਾ ਨਹੀਂ ਲੱਗਦਾ ਸ਼ੋਸ਼ਲ ਮੀਡੀਏ ਦੇ ਰਾਹੀਂ ਅਸੀਂ ਲੋਕਾਂ ਬਾਰੇ ਇੱਕ ਦੂਜੇ ਦੇ ਨੇੜੇ ਆ ਰਹੇ ਹਾਂ ਜਿਸ ਵਿੱਚ ਸ਼ੋਸ਼ਲ ਮੀਡਿਆ ਨੇ ਸਾਡੀ ਬਹੁਤ ਮਦਦ ਕੀਤੀ ਹੈ ਸ਼ੋਸ਼ਲ ਮੀਡਿਆ ਦੇ ਬਹੁਤ ਸਾਰੇ ਨੁਕਸਾਨ ਵੀ ਹਨ ਕਿਉਂਕਿ ਸ਼ੋਸ਼ਲ ਮੀਡਿਆ ਦੇ ਵਿੱਚ ਕੁਛ ਲੋਕ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਫੈਲਾਅ ਰਹੇ ਹਨ ਕਿ ਉਹ ਦੂਜੇ ਲੋਕਾਂ ਨੂੰ ਦੇਖਣ ਵਿੱਚ ਬਹੁਤ ਹੀ ਅਜੀਬ ਲੱਗਦੀ ਹੈ ਅਤੇ ਅਸੀਂ ਪਰਿਵਾਰ ਵਿੱਚ ਬੈਠ ਕੇ ਇਨ੍ਹਾਂ ਚੀਜ਼ਾਂ ਨੂੰ ਨਹੀਂ ਦੇਖ ਸਕਦੇ ਜਿਸ ਦੇ ਨਾਲ਼ ਸਾਡੇ ਬੱਚਿਆਂ ਉੱਤੇ ਬਹੁਤ ਅਸਰ ਪੈਂਦਾ ਹੈ ਅਤੇ ਦੂਜਿਆਂ ਲੋਕਾਂ ਨੂੰ ਦੇਖ ਕੇ ਸਾਡੀ ਆਉਣ ਵਾਲ਼ੀ ਪੀੜ੍ਹੀ ਉੱਤੇ ਬਹੁਤ ਹੀ ਗਲਤ ਅਸਰ ਪੈ ਰਿਹਾ ਹੈ